ਸਤਿ ਸ਼੍ਰੀ ਅਕਾਲ ਜੀ ਉਬਰ ਔਫਿਸ ਤੋਂ ਗੱਲ ਕਰਦੇ ਮੈਂ ਤੁਹਾਡੀ ਸਰਵਿਸ ਦਾ ਹਰ ਰੋਜ਼ ਲਾਭ ਉਠਾਉਂਦਾ ਹਾਂ ਮੈਨੂੰ ਆਪਣੇ ਦਫ਼ਤਰ ਤੋਂ ਘਰ ਅਤੇ ਘਰ ਤੋਂ ਦਫ਼ਤਰ ਉਬਰ ਕੈ ਕੈਬ ਵਿੱਚ ਹੀ ਆਉਂਦਾ ਜਾਂਦਾ ਹਾਂ ਹੁਣ ਮੈਨੂੰ ਪਰਿਵਾਰ ਸਮੇਤ ਯਾਤਰਾ 'ਤੇ ਜਾਣ ਲਈ ਇੱਕ ਵਧੀਆ ਕੈਬ ਦੀ ਜ਼ਰੂਰਤ ਹੈ ਅਸੀਂ ਪੰਜ ਮੈਂਬਰ ਹੋਵਾਂਗੇ ਤੁਸੀਂ ਕਿਰਾਇਆ ਮੈਂਬਰਾਂ ਦੇ ਹਿਸਾਬ ਨਾਲ਼ ਲਵੋਗੇ ਜਾਂ ਕਿਲੋਮੀਟਰ ਦੇ ਹਿਸਾਬ ਨਾਲ਼ ਤੁਸੀਂ ਮੈਨੂੰ ਕੋਈ ਛੋਟ ਵੀ ਦਿਓਗੇ ਮੈਂ ਤੁਹਾਡਾ ਪੱਕਾ ਗਾਹਕ ਹਾਂ ਤੁਸੀਂ ਸਵੇਰੇ ਛੇ ਵਜੇ ਘਰੇ ਕੈਬ ਭੇਜ ਦਿਓ ਮੈਂ ਕੈਬ ਦੀ ਉਡੀਕ ਕਰਾਂਗਾ